ਪੰਜਾਬੀ ਲੋਕ ਆਪਣੀਆਂ ਸੱਭਿਆਚਾਰਕ ਪਰੰਪਰਾਵਾਂ ਨੂੰ ਮਨਾਉਣ ਅਤੇ ਸਨਮਾਨ ਦੇਣ ਲਈ ਆਪਣੀ ਭਾਸ਼ਾ ਦੀ ਵਰਤੋਂ ਕੁਝ ਇਸ ਪ੍ਰਕਾਰ ਕਰਦੇ ਹਨ ਕਿ ਜਿਵੇਂ ਕਿਤੇ ਵੀ ਕੋਈ ਮੇਲਾ ਜਾਂ ਕਿਤੇ ਕੋਈ ਫੰਕਸ਼ਨ ਹੋ ਗਿਆ ਵਿਆਹ ਹੋ ਗਿਆ ਕਿਤੇ ਵੀ ਕੋਈ ਪ੍ਰੋਗਰਾਮ ਹੋ ਗਿਆ ਆਪਾਂ ਕਿਸੇ ਵੀ ਜਗ੍ਹਾ 'ਤੇ ਕਿਸੇ ਨੂੰ ਮਿਲਣ ਜਾਈਦਾ ਜਿੱਦਾਂ ਵੀ ਜਾਈਦਾ ਅਸੀਂ ਸਭ ਤੋਂ ਪਹਿਲਾਂ ਉਹਦੇ ਘਰ ਜਾਂਦੇ ਹਾਂ ਉਸ ਤੋਂ ਬਾਅਦ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਉਸ ਤੋਂ ਬਾਅਦ ਅੱਗੋਂ ਜਵਾਬ ਆਉਂਦਾ ਫਿਰ ਸਤਿ ਸ਼੍ਰੀ ਅਕਾਲ ਉਹ ਵੀ ਬੁਲਾਉਂਦਾ ਹੈ ਤੋ ਇਸੇ ਪ੍ਰਕਾਰ ਆਪਾਂ ਇੱਕ ਦੂਜੇ ਨੂੰ ਸਨਮਾਨ ਦਿੰਦੇ ਹਾਂ ਜੇ ਕੋਈ ਸਾਡੇ ਤੋਂ ਵੱਡਾ ਹੈ ਤਾਂ ਅਸੀਂ ਉਹਦੇ ਪੈਰੀਂ ਹੱਥ ਲਾਉਂਦੇ ਹਾਂ ਜੇ ਸਾਡੇ ਤੋਂ ਛੋਟਾ ਹੈ ਤਾਂ ਉਸ ਨੂੰ ਲਾਡ ਦੁਲਾਰ ਪਿਆਰ ਕਰਦੇ ਹਾਂ ਇਸੇ ਪ੍ਰਕਾਰ ਆਪਾਂ ਆਪਣੀ ਭਾਸ਼ਾ ਦਾ ਵਰਤੋਂ ਕਰਕੇ ਇਹਨਾਂ ਨੂੰ ਸਨਮਾਨ ਦੇ ਸਕਦੇ ਹਾਂ ਜਿਵੇਂ ਕਿ ਆਪਾਂ ਉਹੋ ਜਿਹੀਆਂ ਗੱਲਾਂ ਕਹਿੰਦੇ ਹਾਂ ਜਿਹੜੀ ਕਿ ਅਗਲੇ ਬੰਦੇ ਨੂੰ ਪਸੰਦ ਆਉਣ ਵਧੀਆ ਲੱਗੇ ਅਤੇ ਉਹ ਖੁਸ਼ ਹੋਵੇ ਸਾਡੀ ਗੱਲ ਸੁਣ ਕੇ ਅਤੇ ਸਾਨੂੰ ਵੀ ਆਪਣੇ ਵਿੱਚ ਰਲਾ ਮਿਲਾ ਲਵੇ